ਮੇਰਾ ਭਤੀਜਾ ਜੋ ਕਿ ਸੀਗਿੰਗ ਬਹੁਤ ਵਧੀਆ ਕਰਦਾ ਹੈ ਤੇ ਮੈਂ ਉਹਦੇ ਨਾਲ ਮੁੰਬਈ ਔਡੀਸ਼ਨ ਸਾ ਰੇ ਗਾ ਮਾ ਪਾ ਵਿੱਚ ਗਿਆ ਸੀ ਮੁੰਬਈ ਦੇ ਵਿੱਚ ਅਤੇ ਉੱਥੇ ਜਾ ਕੇ ਮੈਂ ਬਹੁਤ ਜ਼ਿਆਦਾ ਸੰਗੀਤਕਾਰਾਂ ਨੂੰ ਮਿਲਿਆ ਅਤੇ ਬਹੁਤ ਵਧੀਆ ਲੱਗਾ ਅਤੇ ਉੱਥੇ ਹੋਰ ਵੀ ਬਹੁਤ ਸਾਰੇ ਬੱਚੇ ਆਏ ਹੋਏ ਸਨ ਜਿਨ੍ਹਾਂ ਨੇ ਬੜੀ ਵਧੀਆ ਵਧੀਆ ਪਰਫੋਰਮ ਕੀਤਾ ਆਪਣੇ ਆਪ ਨੂੰ ਸਿੰਗਿੰਗ 'ਤੇ ਅਤੇ ਉਹਨਾਂ ਨੇ ਬਹੁਤ ਬਹੁਤ ਗਾਣੇ ਗਾਏ ਅਤੇ ਮੁੰਬਈ ਤੋਂ ਬਾਅਦ ਉਸ ਤੋਂ ਬਾਅਦ 'ਚ ਮੈਂ ਉਹਦੇ ਨਾਲ ਜਲੰਧਰ ਗਿਆ ਜਿੱਥੇ ਇੱਕ ਹੋਰ ਔਡੀਸ਼ਨ ਸੀ ਉਹਦਾ ਅਤੇ ਉੱਥੇ ਵੀ ਕਲਾਸੀਕਲ ਸਿੰਗਿੰਗ ਸੀਗੀ ਅਤੇ ਜੋ ਮੈਂ ਉੱਥੇ ਵੀ ਵੇਖਿਆ ਬਹੁਤ ਸਾਰੇ ਬੱਚੇ ਜਿਹੜੇ ਸੀਗੇ ਪਰਫੋਮ ਕਰ ਰਹੇ ਸੀਗੇ ਅਤੇ ਮੇਰੇ ਭਤੀਜੇ ਨੇ ਵੀ ਬਹੁਤ ਵਧੀਆ ਪਰਫੋਰਮ ਕੀਤਾ ਅਤੇ ਇਹੋ ਜਿਹੇ ਸੰਗੀਤਕਾਰ 'ਤੇ ਜਾ ਕੇ ਇਹੋ ਜਿਹੇ ਸਮਾਗਮ 'ਤੇ ਜਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਕਰਕੇ ਮੈਂ ਇਹਨਾਂ ਜਗ੍ਹਾ 'ਤੇ ਯਾਤਰਾ ਕਰਨੀ ਵੀ ਪਸੰਦ ਕਰਦਾ ਹਾਂ ਅਤੇ ਸਾਨੂੰ ਸਾਰਿਆਂ ਨੂੰ ਵੀ ਸੰਗੀਤ ਦੇ ਵਿੱਚ ਰੁਚੀ ਰੱਖਣੀ ਚਾਹੀਦੀ ਹੈ ਤਾਂ ਕਿ ਸਾਰੇ ਆਪਣੇ ਸੰਗੀਤ ਨੂੰ ਜਿਹੜਾ ਵਾ ਉਹ ਸਾਰੇ ਦੇਸ਼ਾਂ ਤੱਕ ਪਹੁੰਚਾ ਸਕਣ ਅਤੇ ਅਤੇ ਆਪਣੇ ਜਿਹੜੇ ਭਾਸ਼ਾ ਨੂੰ ਉਹਨੂੰ ਵੀ ਵੱਧ ਤੋਂ ਵੱਧ ਵਧਾ ਸਕਣ